ਸਾਡੀ ਰਸੋਈ ਵਿੱਚ ਗੈਸ ਸਿਲੰਡਰ ਮਿਕਸੀ ਗਰਾਇਂਡਰ ਫ਼ਰਿੱਜ ਓਵਨ ਆਦਿ ਸਭ ਚੀਜ਼ਾਂ ਹੁਣ ਉਪਲਬਧ ਹਨ ਜੋ ਕਿ ਪਹਿਲੇ ਸਮੇਂ ਵਿੱਚ ਉਪਲਬਧ ਨਹੀਂ ਸਨ ਜਿਸ ਕਰਕੇ ਕਾਫ਼ੀ ਸਮੱਸਿਆਵਾਂ ਆਉਂਦੀਆਂ ਸਨ ਜਿਵੇਂ ਹੁਣ ਅਸੀਂ ਗੇ ਗੈਸ ਸਿਲੰਡਰ ਦੇ ਰਾਹੀਂ ਜਲਦੀ ਖਾਣਾ ਪਕਾ ਸਕਦੇ ਹਾਂ ਪਰ ਪਹਿਲਾਂ ਸਾਨੂੰ ਚੁੱਲ੍ਹੇ ਦੇ ਉੱਤੇ ਹੀ ਰੋਟੀ ਪਕਾਉਣੀ ਪੈਂਦੀ ਸੀਗੀ ਬਾਰਿਸ਼ ਹੋਵੇ ਮੀਂਹ ਹੋਵੇ ਤੂਫ਼ਾਨ ਹੋਵੇ ਹੁਣ ਅਸੀਂ ਹਰ ਸਮੇਂ ਕੁਛ ਵੀ ਪਕਾ ਕੇ ਖਾ ਸਕਦੇ ਹਾਂ ਸਾਨੂੰ ਮੌਸਮ ਦੇਖਣ ਦੀ ਲੋੜ ਵੀ ਨਹੀਂ ਪੈਂਦੀ ਪਹਿਲਾਂ ਹੁਣ ਜਿਵੇਂ ਪਹਿਲਾਂ ਲੋਕ ਕੁੰਡੀ ਸੋਟੇ ਦੇ ਵਿੱਚ ਆਪਣੇ ਭੋਜਨ ਦੇ ਲਈ ਸਮਾਨ ਕੁਤਰਦੇ ਸਨ ਕੁੱਟਦੇ ਸਨ ਹੁਣ ਮਿਕਸੀ ਦੇ ਨਾਲ ਵੀ ਇਹ ਕੰਮ ਅਸਾਨ ਹੋ ਚੁੱਕਾ ਹੈ ਪਹਿਲਾਂ ਘੜੇ ਵਾਲਾ ਪਾਣੀ ਪੀਂਦੇ ਸਨ ਲੋਕ ਹੁਣ ਫ਼ਰਿੱਜ ਨੇ ਵੀ ਇਹ ਕੰਮ ਅਸਾਨ ਕਰ ਦਿੱਤਾ ਹੈ ਜਦ ਮਰਜ਼ੀ ਠੰਡਾ ਪਾਣੀ ਪੀ ਸਕਦੇ ਹਾਂ ਅਸੀਂ ਜਿਸ ਕਰਕੇ ਹੁਣ ਆਂ ਆਉਣ ਵਾਲੀ ਆਧੁਨਿਕ ਤਕਨੀਕ ਦੇ ਵਿੱਚ ਅਸੀਂ ਹੋਰ ਵੀ ਨਵੀਆਂ ਤਕਨੀਕਾਂ ਵੇਖ ਸਕਦੇ ਹਾਂ ਜਿਸ ਰਾਹੀਂ ਸਾਡੇ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ